ਹਾਂ ਇੱਕ ਵਾਰ ਮੇਰੇ ਨਾਲ ਸਭ ਤੋਂ ਅਣਅਕਿਆਸੀ ਘਟਨਾ ਵਾਪਰੀ ਸੀ ਉਹ ਸ਼ਾਮ ਦਾ ਟਾਈਮ ਸੀ ਮੈਂ ਆਪਣਾ ਪੇਪਰ ਦੇ ਕੇ ਵਾਪਸ ਘਰ ਨੂੰ ਆ ਰਹੀ ਸੀ ਪਰ ਰਾਸਤੇ ਵਿੱਚ ਆਉਂਦੇ ਟਾਇਮ ਮੇਰੀ ਬੱਸ ਖਰਾਬ ਹੋ ਗਈ ਜਿਸ ਦਾ ਕਰਕੇ ਮੈਨੂੰ ਉਹ ਬੱਸ 'ਚੋ ਉੱਤਰ ਕੇ ਦੂਜੀ ਬੱਸ ਦਾ ਇੰਤਜ਼ਾਰ ਕਰਨਾ ਪਿਆ ਅਤੇ ਉਸ ਦਾ ਕਰਕੇ ਮੈਨੂੰ ਬਹੁਤ ਖੱਜਲ ਖੁਆਰ ਵੀ ਹੋਣਾ ਪਿਆ ਜਦੋਂ ਤੱਕ ਦੂਜੀ ਬੱਸ ਨਾ ਆਈ ਮੈਨੂੰ ਉੱਥੇ ਬੈਠ ਕੇ ਇੰਤਜ਼ਾਰ ਕਰਨਾ ਪਿਆ ਜਿਸਦਾ ਕਰਕੇ ਮੇਰਾ ਮੂਡ ਵੀ ਬਹੁਤ ਉਦਾਸ ਹੋ ਗਿਆ ਸੀ ਫਿਰ ਜਦ ਦੂਜੀ ਬੱਸ ਆਈ ਤਾਂ ਫਿਰ ਮੈਂ ਆਪਣੇ ਘਰ ਗਈ ਪਰ ਮੈਨੂੰ ਘਰ ਜਾਂਦਿਆਂ ਜਾਂਦਿਆਂ ਰਾਤ ਪੈ ਗਈ ਸੀ ਅਤੇ